ਭਾਰਤ ਸਰਕਾਰ ਨੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਵੱਛ ਭਾਰਤ ਅਭਿਆਨ ਚਲਾਇਆ ਇਸ ਨਾਲ ਸਮਾਜ ਵਿੱਚ ਬਹੁਤ ਸਾਰੇ ਸੁਧਾਰ ਹੋਏ ਜਿਵੇਂ ਕਿ ਪਹਿਲਾਂ ਸਾਡੇ ਆਲੇ ਦੁਆਲੇ ਸਾਫ਼ ਨਾ ਹੋਣ ਕਾਰਨ ਬਹੁਤ ਸਾਰੇ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਇਸ ਅਭਿਆਨ ਤੋਂ ਬਾਅਦ ਵਾਤਾਵਰਣ ਵਿੱਚ ਬਹੁਤ ਸੁਧਾਰ ਹੋਇਆ ਅਤੇ ਆਡ ਆ ਸਾਡੇ ਆਲੇ ਦੁਆਲੇ 'ਤੇ ਬਹੁਤ ਅਸਰ ਹੋਇਆ ਹੁਣ ਪਰ ਮੈਂ ਇਸ ਮੁਹਿੰਮ ਵਿੱਚ ਹਿੱਸਾ ਲੈਂਦੀ ਹਾਂ ਕਿ ਅਸੀਂ ਆਪਣੇ ਆਲੇ ਦੁਆਲੇ ਫੁੱਲ ਬੂਟੇ ਲਗਾ ਕੇ ਹਰਿਆਲੀ ਪੈਦਾ ਕਰਕੇ ਮੌਸਮ ਨੂੰ ਸਾਫ਼ ਕਰਦੇ ਹਾਂ ਸਾਨੂੰ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਸੁਧਾਰ ਆਪਣੇ ਆਲੇ ਦੁਆਲੇ ਸੁਧਾਰ ਕਰਨ ਦੀ ਲੋੜ ਹੈ